ਹਾਂਜੀ ਮੈਨੂੰ ਸ਼ੇਅਰ ਮਾਰਕੀਟ ਬਾਰੇ ਜਾਣਕਾਰੀ ਹੈ ਕਿਉਂਕਿ ਮੇਰੀ ਪੜ੍ਹਾਈ ਦੀ ਸਪੈਸ਼ਲਾਈਜੇਸ਼ਨ ਹੀ ਫਾਇਨਾਂਸ ਸੀ ਸ਼ੇਅਰ ਮਾਰਕੀਟ ਦੇ ਵਿੱਚ ਅਸੀਂ ਸ਼ੇਅਰਸ ਨੂੰ ਖਰੀਦਦੇ ਅਤੇ ਵੇਚਦੇ ਹਾਂ ਅਤੇ ਇਹਦੇ ਵਿੱਚ ਉਤਰਾਅ ਅਤੇ ਚੜਾਅ ਦਾ ਮਤਲਬ ਹੈ ਜਦੋਂ ਵੀ ਸ਼ੇਅਰ ਮਾਰਕੀਟ ਦੇ ਵਿੱਚ ਜਿਹੜੇ ਵੀ ਆਪਾਂ ਸ਼ੇਅਰਸ ਵਗੈਰਾ ਪਰਚੇਸ ਕਰਦੇ ਹਾਂ ਉਹ ਵਧੀਆ ਜਾ ਰਹੇ ਆ ਉਹ ਪ੍ਰੋਫਿਟ ਅਰਨ ਕਰ ਰਹੇ ਆ ਤਾਂ ਉਹਨੂੰ ਅਸੀਂ ਉਤ ਚੜਾਅ ਬੋਲਦੇ ਹਾਂ ਅਤੇ ਜਦੋਂ ਵੀ ਸ਼ੇਅਰ ਜਿਹੜੇ ਆ ਉਹ ਡਾਊਨ ਜਾ ਰਹੇ ਆ ਤਾਂ ਉਹਨੂੰ ਆਪਾਂ ਉਤਰਾਅ ਬੋਲਦੇ ਹਾਂ ਡਿਜੀਟਲ ਐਪਸ ਨੇ ਭਾਰਤ ਦੇ ਵਿੱਚ ਵਪਾਰ ਦੇ ਵਿੱਚ ਬਹੁਤ ਹੀ ਵਧੀਆ ਤਬਦੀਲੀ ਲਿਆਂਦੀ ਹੈ ਕਿਉਂਕਿ ਹੁਣ ਸਾਨੂੰ ਸਿੱਧਾ ਸ਼ੇਅਰ ਮਾਰਕੀਟ ਦੇ ਵਿੱਚ ਜਾ ਕੇ ਹੀ ਸੇਲ ਪਰਚੇਸ ਨਹੀਂ ਕਰਨੀ ਪੈਂਦੀ ਅਸੀਂ ਆਪਣੀਆਂ ਐਪਸ ਦੇ ਥਰੂ ਜੇ ਕਿਤੇ ਵੀ ਆਪਾਂ ਕਿਸੇ ਵੀ ਜਗ੍ਹਾ 'ਤੇ ਬੈਠੇ ਹੋਏ ਕਿਸੇ ਵੀ ਅ ਦੂਸਰੀ ਜਗ੍ਹਾ 'ਤੇ ਜਿਹੜੇ ਸ਼ੇਅਰ ਮਾਰਕੀਟ ਹੈ ਉੱਥੋਂ ਸ਼ੇਅਰਸ ਨੂੰ ਸ ਖਰੀਦ ਅਤੇ ਵੇਚ ਸਕਦੇ ਹਾਂ ਸੋ ਮੈਨੂੰ ਲੱਗਦਾ ਕਿ ਇਹ ਖਤਰਨਾਕ ਚੀਜ਼ ਨਹੀਂ ਆ ਇਹਨੇ ਸਾਡੀ ਲਾਈਫ਼ ਨੂੰ ਹੋਰ ਵੀ ਜ਼ਿਆਦਾ ਅਸਾਨ ਕਰ ਦਿੱਤਾ ਹੈ ਜਿਹਦੇ ਕਰਕੇ ਸਾਨੂੰ ਵਾਰ ਵਾਰ ਸ਼ੇਅਰ ਮਾਰਕੀਟ ਦੇ ਵਿੱਚ ਜਾ ਕੇ ਉੱਥੇ ਕਿਸੇ ਦੇ ਨਾਲ ਵੀ ਡੀਲ ਕਰਨ ਦੀ ਲੋੜ ਨਹੀਂ ਪੈਂਦੀ ਅਸੀਂ ਆਪਣੀਆਂ ਐਪਸ ਦੇ ਜ਼ਰੀਏ ਹੀ ਆਪਣੇ ਸ਼ੇਅਰ ਜਿਹੜੇ ਹੈ ਉਹ ਖਰੀਦ ਅਤੇ ਵੇਚ ਸਕਦੇ ਹਾਂ